ਹੈਲੋ ਹਾਂਜੀ ਹਾਂਜੀ ਹਾਂਜੀ ਦੱਸੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਾਕੀ ਜਿਵੇਂ ਤੁਸੀਂ ਕਹੋਂਗੇ ਆਪਾਂ ਓਦਾਂ ਦੇ ਈ ਬੈੱਡ ਬਣਵਾਦਾਂਗੇ ਆਪਣੇ ਕੋਲ਼ ਬਹੁਤ ਹੀ ਡਿਜ਼ਾਈਨ ਆਏ ਪਏ ਆ ਜਿਵੇਂ ਤੁਸੀਂ ਆ ਜਿਓ ਜੇ ਆਪਾਂ ਜਿਵੇਂ ਤੁਸੀਂ ਕਹੋਂਗੇ ਆਪਾਂ ਓਦਾਂ ਦੇ ਡਿਜ਼ਾਈਨ ਬਣਾਦਾਂਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨੀ ਅਸੀਂ ਓਦਾਂ ਈ ਤਿਆਰ ਕਰਕੇ ਦੇਵਾਂਗੇ ਜਿਵੇਂ ਤੁਸੀਂ ਕਹੋਂਗੇ ਹਾਂਜੀ ਉਹ ਤਾਂ ਤੁਸੀਂ ਹੁਣ ਦੇਖੋ ਜੇ ਤੁਸੀਂ ਜ਼ਿਆਦਾ ਵਧੀਆ ਬੈੱਡ ਬਨਵਾਣਾ ਤੇ ਉਹ ਦੇ ਹਿਸਾਬ ਨਾਲ਼ ਵੀ ਪੈਸੇ ਜ਼ਿਆਦਾ ਲੱਗਣਗੇ ਜੇ ਤੁਸੀਂ ਸਿੰਪਲ ਬੈੱਡ ਬਨਵਾਣਾ ਆ ਤਾਂ ਫ਼ੇਰ ਓਹਦੇ ਹਿਸਾਬ ਨਾਲ਼ ਥੋਡੇ ਘੱਟ ਪੈਸੇ ਲੱਗਣਗੇ ਉਹ ਤੁਸੀਂ ਆ ਕੇ ਡਿਜ਼ਾਈਨ ਦੇਖ ਲਿਓ ਜੇ ਸ਼ੋਪ ਤੇ ਆ ਕੇ ਤੇ ਫ਼ੇਰ ਆਪਾਂ ਮੰਨ ਕੇ ਚੱਲੋ ਆਪਾਂ ਬਣਾਦਾਂਗੇ ਓਦਾਂ ਦੇ ਬੈੱਡ ਈ ਹਾਂਜੀ ਹਾਂਜੀ ਕੋਈ ਗੱਲ ਨੀ ਅਸੀਂ ਟਾਹਲੀ ਦੀ ਵਧੀਆ ਲੱਕੜ ਲਾਵਾਂਗੇ ਤੇ ਕੋਈ ਸਿਓਂਕ ਨੀ ਲੱਗਣੀ ਕੋਈ ਮਤਲਬ ਕਿ ਤੁਹਾਨੂੰ ਲਾਂਬਾ ਨੀ ਆਊਗਾ ਤੇ ਅਸੀਂ ਵਧੀਆ ਬੈੱਡ ਬਣਾ ਕੇ ਦਿੰਨੇ ਆ ਬਹੁਤ ਸਾਰੇ ਡਿਜ਼ਾਈਨ ਆਏ ਪਏ ਐਗੇ ਕੋਈ ਵੀ ਸਿਲੈਕਟ ਕਰਕੇ ਸਾਨੂੰ ਦੱਸ ਸਕਦੇ ਆ ਤੇ ਅਸੀਂ ਓਦਾਂ ਦੇ ਈ ਬੈੱਡ ਬਣਾ ਕੇ ਦਵਾਂਗੇ ਧਾਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਸੈਡ ਵਾਲ਼ੇ ਹਾਂਜੀ ਇੱਕ ਇੱਕ ਬੈੱਡ ਆਂਦੇ ਆ ਵੀ ਜੁੱਤੇ ਰੱਖਣ ਨੂੰ ਵੀ ਸਾਈਡ ਤੇ ਬਣੇ ਹੁੰਦੇ ਆ ਡਰੋ ਓ ਵਾਲ਼ੇ ਵੀ ਚਾਈਦੇ ਧੋਨੂੰ ਹਾਂਜੀ ਜਿਹੜੇ ਮੰਨ ਕੇ ਚੱਲੋ ਜਿਹੜੇ ਢੋਅ ਆਲੀ ਸਾਈਡ ਦਰਾਜ਼ ਹੁੰਦੇ ਆ ਉਨ੍ਹਾਂ ਦੇ ਦੋ ਦੋ ਰੱਖਣੇ ਹੁੰਦੇ ਆ ਵੀ ਤੁਸੀਂ ਇੱਕ ਆਲ਼ਾ ਲੌਂਗੇ ਕੇ ਦੋ ਦੋ ਆਲ਼ੇ ਹਾਂਜੀ ਕੋਈ ਗੱਲ ਨੀ ਅਸੀਂ ਦੋ ਵਾਲ਼ੇ ਬਣਾਦਾਂਗੇ ਵਧੀਆ ਕਵਾਲਿਟੀ 'ਚ ਬਣਾ ਕੇ ਦੇਵਾਂਗੇ ਹਾਂਜੀ ਕੋਈ ਗੱਲ ਨੀ ਤੁਸੀਂ ਕੱਲ ਆ ਜਿਓ ਜੇ ਤੇ ਆਪਾਂ ਓਥੇ ਡਜੈਨ ਸਲੈਕਟ ਕਰ ਲਿਓ ਜੇ ਫੇਰ ਬਣਾਦਾਂਗੇ ਠੀਕ ਐ ਜੀ ਓਕੇ